ਅਠਾਈ ਸਤੰਬਰ ਉੱਨੀ ਸੌ ਛਿਆਨਵੇਂ ਉਨੱਤੀ ਅਗਸਤ ਉੱਨੀ ਸੌ ਦੋ ਪੰਦਰ੍ਹਾਂ ਸਤੰਬਰ ਦੋ ਹਜ਼ਾਰ ਇੱਕ ਉਨੱਤੀ ਸਤੰਬਰ ਦੋ ਹਜ਼ਾਰ ਤਿੰਨ ਇੱਕ ਅਗਸਤ ਦੋ ਹਜ਼ਾਰ ਉੱਨੀ